ਹਾਂਜੀ ਅਸੀਂ ਮੈਂ ਅਕਸਰ ਹੀ ਜਿਹੜਾ ਸਕਰੈਚ ਤੋਂ ਆ ਘਰ ਵਿੱਚ ਪਕਵਾਨ ਬਣਾਉਂਦੀ ਰਹਿੰਦੀ ਹਨ ਅਤੇ ਇਹਦੇ ਵਿੱਚ ਜ਼ਿਆਦਾਤਰ ਮੈਂ ਜਿੱਦਾਂ ਸੈਲਡ ਹੋ ਗਿਆ ਹੈ ਨਾ ਜ਼ਿਆਦਾ ਸੈਲਡ ਬਣਾਉਂਦੀ ਹਾਂ ਕਿਉਂਕਿ ਸਾਡੇ ਦੇ ਵਿੱਚ ਘਰਾਂ ਵਿੱਚ ਪਾਇਆ ਜਾਂਦਾ ਹਨ ਕਿ ਜਿਹੜੀਆਂ ਸਿਰਫ ਸਬਜ਼ੀਆਂ ਪਈਆਂ ਹੁੰਦੀਆਂ ਹਨ ਕੱਚੀਆਂ ਸਬਜ਼ੀਆਂ ਹੋ ਗਈਆਂ ਹੈ ਨਾ ਜਾਂ ਹੋਰ ਧਨੀਆ ਹੋ ਗਿਆ ਜਾਂ ਡਰੈਸਿੰਗਜ ਜਿਹਨੂੰ ਕਹਿ ਲਓ ਆਪਾਂ ਪਈਆਂ ਹੁੰਦੀਆਂ ਅਤੇ ਉਹ ਉਸ ਤੋਂ ਅਸੀਂ ਇੱਕ ਸਕ੍ਰੈਚ ਹੋਈ ਆ ਕਹਿ ਲਓ ਡਿਸ਼ ਬਣਾ ਸਕਦੇ ਹਾਂ ਅਤੇ ਇਹ ਮੈਨੂੰ ਇਸ ਲਈ ਪਸੰਦ ਹੈ ਕਿਉਂਕਿ ਇੱਕ ਤਾਂ ਇਹ ਸਿੰਪਲ ਅਤੇ ਇੱਕ ਸੌਖੇ ਤਰੀਕੇ ਨਾਲ ਘਰ ਦੇ ਵਿੱਚ ਹੀ ਬਣ ਜਾਂਦਾ ਦੂਜਾ ਕਿ ਇਹ ਘੱਟ ਐਕਸਪੈਂਸਿਵ ਹੁੰਦਾ ਕਿ ਇਹ ਜਿਹੜਾ ਹੈਗਾ ਇਹਦੇ ਵਿੱਚ ਖਰਚਾ ਘੱਟ ਆਉਂਦਾ ਤੁਸੀਂ ਇਹ ਵਾਲੀ ਕੁਕਿੰਗ ਜਿਹੜੀ ਸਕਰੈਚ ਕੁਕਿੰਗ ਹੈਗੀ ਆ ਉਹ ਆਪਣੇ ਘਰ ਦੇ ਵਿੱਚ ਹੀ ਮੌਜੂਦ ਚੀਜ਼ਾਂ ਤੋਂ ਬਣਾ ਸਕਦੇ ਹਾਂ ਹੈ ਨਾ ਤੁਹਾਨੂੰ ਕੋਈ ਜ਼ਿਆਦਾ ਇਹਦੇ ਲਈ ਪ੍ਰਬੰਧ ਕਰਨ ਦੀ ਲੋੜ ਨਹੀਂ ਜਾਂ ਜ਼ਿਆਦਾ ਤੁਹਾਡੇ ਕੋਈ ਪੈਸੇ ਨਹੀਂ ਖਰਚ ਖਰਚਣ ਦੀ ਲੋੜ ਪੈਂਦੀ ਅਤੇ ਅਗ ਹੋਰ ਇਹਦੇ ਵਿੱਚ ਕੀ ਹੁੰਦਾ ਆ ਕਿ ਆਪਾਂ ਜਿਹੜੀਆਂ ਬਚੀਆਂ ਹੋਈਆਂ ਸਾਡੀਆਂ ਡਿਨਰ ਹੋ ਗਏ ਲੰਚ ਹੋ ਗਏ ਉਹਨਾਂ ਵਿੱਚ ਵੀ ਕਈ ਚੀਜ਼ਾਂ ਤੋਂ ਆਪਾਂ ਜਿਹੜੀ ਹੈਗੀ ਸਕਰੈਚ ਕੁਕਿੰਗ ਕਰ ਸਕਦੇ ਹਾਂ ਉਹਨਾਂ ਨੂੰ ਵਰਤ ਕੇ ਵੀ ਅਤੇ ਇਹਦੇ ਨਾਲ ਜਿਹੜਾ ਹੈਗਾ ਉਹ ਫੂਡ ਜਿਹੜਾ ਹੈਗਾ ਖਾਣਾ ਹੈਗਾ ਉਹਦੀ ਘੱਟ ਬੇਸਟਏਜ ਘੱਟ ਹੁੰਦੀ ਹੈ ਅਤੇ ਹੋਰ ਇਹਦੇ ਵਿੱਚ ਜਿਹੜਾ ਇਹ ਜ਼ਿਆਦਾ ਹੈਲਦੀ ਮੰਨਿਆ ਜਾਂਦਾ ਆ ਕਿਉਂਕਿ ਇਹ ਇੱਕ ਤਾਂ ਆਪਾਂ ਇਹਨੂੰ ਫਰੈਸ਼ ਬਣਾਉਂਦੇ ਹਾਂ ਹੈ ਨਾ ਉਸੇ ਵੇਲੇ ਬਣਾ ਕੇ ਰੱਖ ਲੈਂਦੇ ਹਾਂ ਅਤੇ ਇਹਦੇ ਵਿੱਚ ਕੋਈ ਪੈਕੇਜ ਮੀਲ ਨਹੀਂ ਹੁੰਦੇ ਸਨੈਕਸ ਨਹੀਂ ਹੁੰਦੇ ਇਸ ਕਰਕੇ ਇਹਦੀ ਨਿਊਟਰੀਸ਼ਸ਼ ਵੈਲੀਊ ਜਿਹੜੀ ਉਹ ਜ਼ਿਆਦਾ ਹੁੰਦੀ ਇਸ ਕਰਕੇ ਮੇਰੇ ਨੂੰ ਮੈਨੂੰ ਇਹਨਾਂ ਚੀਜ਼ਾਂ ਤੋਂ ਜ਼ਿਆਦਾ ਮੈਂ ਪ੍ਰੇਰਿਤ ਹੁੰਦੀ ਹਾਂ